ਹੈਲੋ ਹਾਂਜੀ ਹਾਂਜੀ ਦਿਲਪ੍ਰੀਤ ਸਿਆਂ ਕੀ ਹਾਲ ਆ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾ ਕੀ ਬਣਦਾ ਅੱਛਾ ਮੈਂ ਤਾਂ ਆਪ ਭਰਾਵਾ ਹਾਲੇ ਫਸਲ ਵੱਢ ਕੇ ਆਉਂਦੀ ਆ ਹੁਣ ਸ਼ਾਮ ਤੱਕ ਜੰ ਦੰ ਢੋਵਾਂਗੇ ਟਰੈਕਟਰ ਜਾਂ ਟਰਾਲੀ 'ਚ ਪਾਉਂਦੇ ਹਾਂ ਉਹਨੂੰ ਇਕੱਠੀ ਕਰਕੇ ਫਿਰ ਕੱਲ ਲੈ ਕੇ ਜਾਂਦੇ ਹਾਂ ਉਹਨੂੰ ਮੰਡੀ ਰੇਟ ਪਵਾਈਏ ਉਹਦਾ ਵੀ ਹਾਂ ਹੋਰ ਸੁਣਾ ਕਿਵੇਂ ਕਿਹੋ ਜਿਹੀ ਹੋਈ ਫਸਲ ਐਤਕੀ ਉਹੀ ਆ ਭਰਾਵਾ ਉਹਦਾ ਬਦਲਦੇ ਮੌਸਮ ਨੇ ਇੰਨਾ ਜਲੂਸ ਕੱਢਤਾ ਨਾ ਧਰਤੀ ਦਾ ਕੀ ਰਹੇ ਰੱਬ ਦਾ ਨਾਂ ਐਤਕੀ ਤਾਂ ਧੁੰਦ ਲਵਾਉਣੀ ਸੀਗੀ ਚੱਜ ਨਾਲ ਉਹਨੂੰ ਕਣਕ ਨੂੰ ਨਾ ਚੱਜ ਨਾਲ ਧੁੰਦ ਲੱਗੀ ਹੈ ਇਹਨੂੰ ਨਾ ਤੇ ਆਪਾਂ ਹਨਾ ਚੱਜ ਨਾਲ ਉਹ ਹੋਈ ਆ ਫਸਲ ਹੋਈ ਆ ਨਾ ਇੰਨਾ ਝਾੜ ਨਿਕਲਿਆ ਐਤਕੀ ਔਰ ਬਾਹਲੀ ਮਾੜੀ ਹੋਈ ਆ ਐਤਕੀ ਤਾਂ ਫਸਲ ਗੱਲ ਕਰਕੇ ਆਇਆਂ ਉਹਦੇ ਨਾਲ ਜਾ ਕੇ ਗੱਲ ਕੀਤੀ ਉਹ ਜਮ੍ਹਾਂ ਹੀ ਮਾੜੀ ਛੋਟੇ ਛੋਟੇ ਜਿਹੇ ਬੀਜ ਨਿਕਲੇ ਆ ਤਾਂ ਉਹ ਆਟਾ ਪੀਹ ਕੇ ਦੇਖਿਆ ਨਾ ਉਹ ਆਟਾ ਵਧੀਆ ਨਾ ਗੁਣ ਜਿਵੇਂ ਹੁਣ ਕਹਿੰਦੇ ਉਹਦਾ ਭਾਰ ਹੁੰਦਾ ਮਾੜਾ ਮੋਟਾ ਬੀਜਾਂ ਦਾ ਉਹ ਵੀ ਕੁਝ ਨਹੀਂ ਹੈਗਾ ਐਤਕੀ ਫਸਲ ਹੋਈ ਬਹੁਤ ਥੋੜ੍ਹੀ ਆ ਮੈਂ ਜਾ ਕੇ ਅੱਜ ਹੁਣ ਜਾ ਕੇ ਜੋਖ ਕਰਾਵਾਂਗੇ ਮੈਂ ਕਿਹਾ ਸਾਡੀ ਤਾਂ ਸਾਰੀ ਮਸਾਂ ਚਾਲੀ ਪੰਜਾਹ ਕੁਇੰਟਲ ਟਨ ਨਿਕਲਣੀ ਆ ਹੋਰ ਬਹੁਤ ਬੁਰਾ ਹਾਲ ਆ ਭਰਾ ਹੁਣ ਤਾਂ ਘਰ ਵਿਆਹ ਵੀ ਖੜ੍ਹ ਗਿਆ ਆ ਕੇ ਹਾਲੇ ਕੁੜੀ ਦਾ ਉਹਦਾ ਵੀ ਕਰਵਾਉਣਾ ਹਾਲੇ ਫਸਲ ਹੋਈ ਨਹੀਂ ਹੈਗੀ ਸਮਝ ਨਹੀਂ ਆਉਂਦਾ ਪੈਸੇ ਲਾਈਏ ਤਾਂ ਲਾਈਏ ਕਿੱਥੋਂ ਹੋਰ ਨਾ ਐਨੀ ਤਕੜੀ ਜ਼ਮੀਨ ਆ ਆਪਣੇ ਕੋਲ ਵੀ ਕਹਿ ਦੇਈਏ ਬਹੁਤ ਹੁੰਦੇ ਆ ਦਸ ਕਿੱਲੇ ਸੀਗੇ ਦੋ ਕਿੱਲੇ ਤਾਂ ਸਾਰੇ ਮੀਂਹ ਨਾਲ ਹੀ ਬਿਠਾਤੇ ਸਾਰੇ ਦੇ ਸਾਰੇ ਥੱਲੇ ਮੀਂਹ ਪੈ ਗਿਆ ਸਾਰੀ ਸਾਰੀ ਫਸਲ ਏ ਥੱਲੇ ਬਹਿ ਗਈ ਉਦੋਂ ਕੁਛ ਵੀ ਨਹੀਂ ਹੋਇਆ ਜੋ ਮਸ਼ੀਨ ਦਾ ਜ਼ੋਰ ਸਮਾਂ ਦੁੱਗਣਾ ਲੱਗ ਗਿਆ ਉੱਥੇ ਵੱਢਦੇ ਨੂੰ ਮਸ਼ੀਨ ਥੱਲੇ ਪਾਸੇ ਵੱਢਣਾ ਉਹਦਾ ਔਖਾ ਹੋ ਗਿਆ ਉਹ ਸਾਰਾ ਹੱਥੀਂ ਨਾਲ ਹੱਥ ਨਾਲ ਵੱਢਣਾ ਪਿਆ ਉੱਥੋਂ ਹੋਰ ਤੇਲ ਦਾ ਮਸ਼ੀਨ ਦਾ ਦੁੱਗਣਾ ਲੱਗ ਗਿਆ ਇੰਨੇ ਬਣਨੇ ਨਹੀਂ ਸੀਗੇ ਜਿੰਨੇ ਐਤਕੀ ਮਸ਼ੀਨ ਦੇ ਤੇਲ 'ਤੇ ਲੱਗ ਗਏ ਸਾਡੀ ਤਾਂ ਆਪਦੀ ਕੰਬਾਈਨ ਵੀ ਨਹੀਂ ਹੈਗੀ ਅਸੀਂ ਕਿਸੇ ਚਲ ਕਿਸੇ ਪਾਸੇ ਭੇਜ ਕੇ ਹੋਰ ਜੇ ਮਾੜੇ ਹੈਗੇ ਜੇ ਉਹਨਾਂ ਕੋਲ ਭੇਜ ਦਾਂਗੇ ਚਲੋ ਉ ਉਹਨਾਂ ਤੋਂ ਕਿਰਾਇਆ ਕਰੂਆ ਆ ਜਾਊਗਾ ਅਸੀਂ ਤਾਂ ਆਪ ਮੰਗ ਕੇ ਕਿਰਾਇਆ ਬੇਲੀ ਦੀ ਸੀਗੀ ਯਾਰ ਮੇਰੇ ਦੀ ਕੰਬਾਈਨ ਚਲ ਉਹਦੇ ਨਾਲ ਇੰਨਾ ਸਰ ਗਿਆ ਵੀ ਉਹਨੇ ਠੀਕ ਠਾਕ ਰੇਟ ਵਿੱਚ ਆਪਾਂ ਨੂੰ ਲਾ ਤਾ ਬਾਹਲਾ ਠੋਕ ਠੋਕਿਆ ਵੀ ਨਹੀਂ ਹੈਗਾ ਨਾ ਬਾਹਲਾ ਠੋਕ ਕੇ ਉਹਨੇ ਆਰਾਮ ਨਾਲ ਕਰਤਾ ਕੰਮ ਬੰਦਾ ਵੀ ਆਪਦਾ ਹੀ ਭੇਜਤਾ ਸੀ ਉਹਨੇ ਵੀ ਇਹਦੀ ਜਾ ਕੇ ਫਸਲ ਵੱਢ ਆ ਇੰਨਾ ਕੁ ਬਚਾਅ ਰਹਿ ਗਿਆ ਤੂੰ ਦੱਸ ਤੂੰ ਦੱਸ ਤੁਹਾਡਾ ਕੀ ਬਣਿਆ ਕਿਹੋ ਜਿਹੀ ਹੋਈ ਫਸਲ ਤੁਹਾਡੀ ਮੌਸਮ ਵੀ ਬਾਹਲਾ ਫਰਕ ਪੈ ਗਿਆ ਯਾਰ ਬਦਲ ਕੇ ਨਾ ਮੌਸਮ ਉਹਦੇ ਨਾਲ ਅਤੇ ਨਾ ਚੱਜ ਨਾਲ ਫਸਲ ਹੋ ਰਹੀ ਆ ਨਾ ਹੋਣ ਦੇ ਰਹੇ ਆ ਗਰਮੀਆਂ ਇੰਨੀਆਂ ਭੈੜੀਆਂ ਭੈੜੀਆਂ ਹੋਈਆਂ ਪਈਆਂ ਇਹੋ ਜਿਹੀ ਹੋਈ ਪਈ ਆ ਨਾ ਉਹਦੇ ਵਿੱਚ ਚੱਜ ਨਾਲ ਉਹ ਗੱਲ ਬਣ ਰਹੀ ਹੈ ਦੇਖਦੇ ਹੁਣ ਕੀ ਬਣਦਾ ਚੱਲ ਤੈਨੂੰ ਮੈਂ ਕਰਦਾਂ ਮੈਨੂੰ ਬੁਲਾ ਰਹੇ ਆ ਮੈਂ ਸੁਣ ਆਵਾਂ ਜਾ ਕੇ ਗੱਲ